ਸਰਕਾਰ ਤੋਂ ਖੇਤੀਬਾੜੀ ਲਈ ਨਵਾਂ ਬਿਜਲੀ ਕਨੈਕਸ਼ਨ ਲੈਣ ਲਈ ਸਭ ਤੋਂ ਪਹਿਲਾਂ ਕਿਸਾਨ ਹੈ ਜਿਹੜੇ ਫਾ ਫਾਰਮ ਭਰਦੇ ਨੇ ਫਿਰ ਕੁਛ ਟਾਈਮ ਬਾਅਦ ਉਹ ਫਾਰਮ ਨਿਕਲ ਜਾਂਦੇ ਨੇ ਅਤੇ ਜਿਹਨਾਂ ਜਿਹਨਾਂ ਦਾ ਨਾਮ ਆਇਆ ਹੁੰਦਾ ਅਤੇ ਫਿਰ ਉਹ ਕਿਸਾਨ ਆਪਣਾ ਜਿਹੜਾ ਬਿਜਲੀ ਕਨੈਕਸ਼ਨ ਹੈ ਉਹ ਲੈ ਸਕਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਖੇਤਾਂ ਵਿੱਚ ਟਰਾਂਸਫਾਰਮਰ ਲਾ ਦਿੱਤੇ ਜਾਂਦੇੇ ਨੇ ਅਤੇ ਉਹਨਾਂ ਨੂੰ ਬਿਜਲੀ ਕਨੈਕਸ਼ਨ ਆ ਜਿਹੜਾ ਦਿੱਤਾ ਦੇ ਦਿੱਤਾ ਜਾਂਦਾ ਅਤੇ ਲੋਡ ਨੂੰ ਵਧਾਉਣ ਦੇ ਲਈ ਵੀ ਕਿਸਾਨਾਂ ਨੂੰ ਅਪਲਾਈ ਕਰਨਾ ਪੈਂਦਾ ਗਾ ਜਿਹੜਾ ਵੀ ਕਿਸਾਨ ਜਿੰਨਾ ਲੋਡ ਵਧਾਉਣਾ ਚਾਹੁੰਦਾ ਗਾ ਉਸ ਦੇ ਲਈ ਉਹ ਇੱਕ ਐਪਲੀਕੇਸ਼ਨ ਦਿੰਦਾ ਗਾ ਅਤੇ ਉਸ ਤੋਂ ਬਾਅਦ ਹੀ ਉਹਨਾਂ ਦਾ ਲੋਡ ਵਧਦਾ ਗਾ ਅਤੇ ਪਰ ਇਹਦੇ ਲਈ ਕਈ ਕਿਸਾਨਾਂ ਨੂੰ ਸਮੱਸਿਆਵਾਂ ਵੀ ਆਉਂਦੀਆਂ ਨੇ ਅਤੇ ਜਿਹਦੇ ਵਿੱਚ ਛੋਟੇ ਕਿਸਾਨ ਹੈ ਜਿਹੜਾ ਸਭ ਤੋਂ ਜ਼ਿਆਦਾ ਸਫਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਦਾ ਜਿਹੜਾ ਲੋਡ ਆ ਅਸਾਨੀ ਨਾਲ ਨਹੀਂ ਵਧਾਇਆ ਜਾਂਦਾ ਗਾ ਕਿਉਂਕਿ ਉਹਨਾਂ ਦੀ ਕੋਈ ਜਾਣ ਪਹਿਚਾਣ ਨਹੀਂ ਹੁੰਦੀ ਗੀ ਇਹਤੇ ਇਹਦੇ ਵਿੱਚ ਵੱਡੇ ਕਿਸਾਨ ਆ ਜਿਹੜੇ ਉਹਨਾਂ ਦੀ ਜਾਣ ਪਹਿਚਾਣ ਹੋਣ ਕਰਕੇ ਉਹਨਾਂ ਨੂੰ ਤਾਂ ਲੋਡ ਅਸਾਨੀ ਨਾਲ ਵਧਾ ਦਿੱਤਾ ਜਾਂਦਾ ਪਰ ਛੋਟੇ ਕਿਸਾਨਾਂ ਨੂੰ ਆਸਾਨੀ ਦੇ ਨਾਲ ਲੋਡ ਵਧਾਇਆ ਨਹੀਂ ਜਾਂਦਾ